ਅੱਜ ਕੱਲ੍ਹ ਦੇ ਨੌਜਵਾਨ ਅਤੇ ਬੱਚੇ ਮੋਬਾਇਲ ਤੱਕ ਹੀ ਸੀਮਿਤ ਰਹਿ ਗਏ ਹਨ ਉਹਨਾਂ ਨੂੰ ਖੇਡਾਂ ਦਾ ਮਹੱਤਵ ਨਹੀਂ ਪਤਾ ਔਰ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਪ੍ਰਕਾਰ ਦੀਆਂ ਖੇਡਾਂ ਕ੍ਰਿਕਟ ਤੋਂ ਲੈ ਕੇ ਹਾਕੀ ਤੱਕ ਸਭ ਫੋਨਾਂ 'ਤੇ ਖੇਡਦੇ ਹਨ ਅਤੇ ਇੱਕੋ ਜਗ੍ਹਾ 'ਤੇ ਸਾਰਾ ਦਿਨ ਬੈਠੇ ਰਹਿੰਦੇ ਹਨ ਜਿਹਨਾਂ ਨਾਲ ਕਿ ਉਹ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਕਈ ਵੀ ਜਿਵੇਂ ਕਈ ਵਾਰ ਉਹਨਾਂ ਦੀ ਨਿਗਾਹ ਘੱਟ ਜਾਂਦੀ ਹੈ ਅਤੇ ਕਈ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਮੈਨੂੰ ਲੱਗਦਾ ਉਹਨਾਂ ਨੂੰ ਖੇਡਾਂ ਦੀ ਮਹੱਤਤਾ ਹੀ ਨਹੀਂ ਪਤਾ ਅੱਜ ਕੱਲ੍ਹ ਦੇ ਮਾਂ ਪਿਓ ਆਪਣੇ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੰਦੇ ਜਦੋਂ ਕਿ ਉਹਨਾਂ ਨੂੰ ਦੇਣੀ ਚਾਹੀਦੀ ਹੈ ਵੀ ਉਹ ਕਿਸ ਤਰ੍ਹਾਂ ਖੇਡਦੇ ਸਨ ਗਰਾਊਂਡ ਦੇ ਵਿੱਚ ਇਕੱਠੇ ਹੋ ਕੇ ਅਤੇ ਕਿਸ ਤਰ੍ਹਾਂ ਉਹ ਆਪਣੇ ਮਾਂ ਪਿਓ ਨਾਲ ਖੇਡਦੇ ਸਨ ਅਤੇ ਅੱਜ ਕੱਲ੍ਹ ਦੇ ਟੀਚਰਸ ਵੀ ਇਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਦੇ ਅਤੇ ਨਾ ਹੀ ਉਹਨਾਂ ਨੂੰ ਖੇਡਾਂ ਦੀ ਜਿਹੜੀ ਚੀਜ਼ ਸਮਾਨ ਹੈਗਾ ਉਹ ਲੈ ਕੇ ਦਿੰਦੇ ਹਨ ਸਕੂਲ ਦੇ ਵਿੱਚ ਇੱਕ ਕਮਰਾ ਹੋਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਖੇਡਾਂ ਦਾ ਸਾਰਾ ਸਮਾਨ ਮਿਲ ਜਾਵੇ ਅਤੇ ਉਹਨਾਂ ਨੂੰ ਜਾਣਕਾਰੀ ਮਿਲੇ ਕਿ ਖੇਡਾਂ ਨਾਲ ਕਿੰਨੀ ਤੰਦਰੁਸਤੀ ਆਉਂਦੀ ਹੈ ਅਤੇ ਉਹਨਾਂ ਨੂੰ ਖੇਡਣਾ ਚਾਹੀਦਾ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਇਸ ਪ੍ਰਕਾਰ ਸਿੱਖ ਸਕਦੇ ਹੈ ਵੀ ਖੇਡਾਂ ਦੀ ਮਹੱਤਤਾ ਕਿੱਦਾਂ ਮਿਲਦੀ ਹੈ